ਯੋਗਾ ਅਸੀਂ ਇੰਡੀਆ ਟੀ ਵੀ 'ਤੇ ਦੇਖਦੇ ਹਨ ਰਾਮਦੇਵ ਬਾਬਾ ਜੀ ਯੋਗਾ ਬਹੁਤ ਵਧੀਆ ਸਿਖਾਉਂਦੇ ਹਨ ਅਤੇ ਮੈਂ ਵੀ ਉਹਨਾਂ ਨੂੰ ਦੇਖ ਕੇ ਯੋਗਾ ਕਰਦੀ ਹਾਂ ਪਰੰਤੂ ਕਈ ਲੋਕ ਇਹ ਯੋਗਾ ਨਹੀਂ ਕਰ ਪਾਉਂਦੇ ਕਿਉਂਕਿ ਕਈ ਲੋਕ ਬਹੁਤ ਮੋਟੇ ਹੁੰਦੇ ਹਨ ਜਿਹਨਾਂ ਤੋਂ ਇਹ ਯੋਗਾ ਕਰਨਾ ਨਹੀਂ ਹੁੰਦਾ ਉਹਨਾਂ ਦਾ ਸਰੀਰ ਇੰਨਾ ਕੁ ਮੋਟਾ ਹੋ ਜਾਂਦਾ ਹੈ ਕਿ ਉਹਨਾਂ ਦਾ ਸਰੀਰ ਨਹੀਂ ਕਰ ਪਾਉਂਦਾ ਯੋਗਾ ਕਰਨਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਇਸ ਨਾਲ ਸਾਡੇ ਸਰੀਰ ਬਿਲਕੁਲ ਤੰਦਰੁਸਤ ਅਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਯੋਗਾ ਸਾਨੂੰ ਰੋਜ਼ ਸਵੇਰੇ ਕਰਨਾ ਚਾਹੀਦਾ ਹੈ ਧੰਨਵਾਦ